ਅ ਹਾਂਜੀ ਮੈਂ ਪਿਛਲੇ ਦਿਨੀਂ ਦਰਸ਼ਨਾਂ ਦੇ ਲਈ ਪਟਨਾ ਸਾਹਿਬ ਗਿਆ ਸੀਗਾ ਜੀ ਇੱਥੋਂ ਜਾਖਲ ਤੋਂ ਜਾਖਲ ਹਰਿਆਣੇ ਦੇ ਵਿੱਚ ਪੈਂਦਾ ਆ ਵੈਸੇ ਪਟਿਆਲਾ ਜ਼ਿਲ੍ਹਾ ਆ ਮੇਰਾ ਪਰ ਸਾਨੂੰ ਜਾਖਲ ਜਿਹੜਾ ਜੰਕਸ਼ਨ ਹੈਗਾ ਆ ਭਾਰਤ ਦੇ ਵਿੱਚ ਹਰਿਆਣੇ ਦੇ ਵਿੱਚ ਡਿਸਟ੍ਰਿਕਟ ਫ਼ਤਿਹਾਬਾਦ ਦੇ ਵਿੱਚ ਸਾਨੂੰ ਨੇੜੇ ਪੈ ਜਾਂਦਾ ਚਾਲੀ ਕੁ ਕਿਲੋਮੀਟਰ ਸਾਡੇ ਪਿੰਡ ਤੋਂ ਸੋ ਇਸ ਕਰਕੇ ਅਸੀਂ ਜਦੋਂ ਦਿੱਲੀ ਜਾਂ ਅੰਮ੍ਰਿਤਸਰ ਜਾਂ ਹੋਰ ਥਾਵਾਂ 'ਤੇ ਹਜ਼ੂਰ ਸਾਹਿਬ ਪਟਨਾ ਸਾਹਿਬ ਜਾਣਾ ਹੁੰਦਾ ਤਾਂ ਅਸੀਂ ਉਸ ਜਿਹੜਾ ਹੈਗਾ ਜੰਕਸ਼ਨ ਨੂੰ ਰੇਲਵੇ ਸਟੇਸ਼ਨ ਨੂੰ ਅਸੀਂ ਅਸੀਂ ਪ੍ਰੈਫਰ ਕਰਦੇ ਹੈਗੇ ਹਾਂ ਤਾਂ ਅਸੀਂ ਪਟਨਾ ਸਾਹਿਬ ਗਏ ਸੀਗੇ ਉੱਥੋਂ ਅਤੇ ਐਕਸਪ੍ਰੈਸ ਟ੍ਰੇਨ ਦੇ ਉੱਤੇ ਅਸੀਂ ਗਏ ਸੀਗੇ ਅਤੇ ਟ੍ਰੇਨ ਦੀ ਜਿਹੜੀ ਹੈਗੀ ਆ ਅਸੀਂ ਬੁਕਿੰਗ ਕਰਵਾਈ ਸੀਗੀ ਏ ਸੀ ਕੋਚ ਦੀ ਬੁਕਿੰਗ ਕਰਵਾਈ ਸੀਗੀ ਫੈਮਿਲੀ ਸਮੇਤ ਮੈਂ ਗਿਆ ਸੀਗਾ ਅਤੇ ਸੀਟਾਂ ਨੇ ਜਿਹੜੀਆਂ ਬਹੁਤ ਹੀ ਸਾਫ਼ ਸੁਥਰੀਆਂ ਸੀਗੀਆਂ ਬਹੁਤ ਆਰਾਮਦਾਇਕ ਸੀ ਟ੍ਰੇਨ ਜਿਹੜੀ ਹੈਗੀ ਹੈ ਬਾਥਰੂਮ ਬਹੁਤ ਸਾਫ਼ ਸੀਗੇ ਬਰਥ ਜਿਹੜਾ ਹੈਗਾ ਅਸੀਂ ਉਹ ਤਿੰਨੇ ਹੀ ਬੁੱਕ ਕਰਵਾ ਲਏ ਸੀਗੇ ਫਸਟ ਸੈਕਿੰਡ ਥਰਡ ਅਤੇ ਇੰਜਨ ਦਾ ਸ਼ੋਰ ਕੋਈ ਨਹੀਂ ਸਾਨੂੰ ਮਹਿਸੂਸ ਹੋਇਆ ਅੰਦਰ ਕਿਉਂਕਿ ਉਹ ਨੋਇਸ ਪਰੂਫ਼ ਜਿਹੜੇ ਉਹਦੇ ਵਿੱਚ ਜਿਹੜੇ ਸ਼ੀਸ਼ੇ ਜਿਹੜੇ ਹੈਗੇ ਨੇ ਉਹ ਗਲਾਸਿਸ ਲੱਗੇ ਹੋਏ ਸੀਗੇ ਉਹ ਜਿਹੜੀ ਗੱਲ ਆ ਟਰੈਕ ਬਹੁਤ ਸਾਫ਼ ਕਲੀਅਰ ਸੀਗਾ ਰਾਹ ਦੇ ਵਿੱਚ ਸਾਨੂੰ ਕੋਈ ਬਹੁਤੀ ਹਰਡਸਲ ਵੀ ਜਿਹੜੀਆਂ ਹੈ ਨਹੀਂ ਜਿਵੇਂ ਕਈ ਵਾਰ ਟ੍ਰੇਨ ਨੂੰ ਪਾਸ ਦੇਣਾ ਪੈਂਦਾ ਐਕਸਪ੍ਰੈਸ ਟ੍ਰੇਨ ਹੋਣ ਕਰਕੇ ਕੋਈ ਰਾਹ ਦੇ ਵਿੱਚ ਰੁਕਾਵਟ ਪੈਦਾ ਨਹੀਂ ਹੋਈ ਉਹ ਬਹੁਤ ਹੀ ਸੋਹਣਾ ਸਫ਼ਰ ਜਿਹੜਾ ਹੈਗਾ ਉਹ ਸਾਡਾ ਰਿਹਾ ਅਤੇ ਯਾਤਰਾ ਕਰਕੇ ਅਸੀਂ ਵਾਪਸ ਵੀ ਮਤਲਬ ਜਿਹੜਾ ਹੈਗਾ ਉਹ ਇੰਡੀਅਨ ਐਕਸਪ੍ਰੈਸ ਦੇ ਉੱਤੇ ਹੀ ਜਿਹੜਾ ਆਏ ਸੀਗੇ ਸੋ ਬਹੁਤ ਹੀ ਸੋਹਣਾ ਸਫ਼ਰ ਰਿਹਾ ਜੀ ਥੈਂਕ ਯੂ